ਹੈਲੋ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਹੋਰ ਕੀ ਹਾਲ ਜੀ ਹਾਂਜੀ ਸਰ ਬਹੁਤ ਮੰਦਾ ਹਾਲ ਹੈ ਸਰਕਾਰਾਂ ਜੋ ਵੀ ਪੈਸੇ ਆਉਂਦੇ ਖਾਈ ਜਾਂਦੀਆਂ ਵਾ ਕੁਝ ਨਹੀਂ ਹੋ ਰਿਹਾ ਟੋਏ ਟੱਪੇ ਉੱਦਾਂ ਹੀ ਪਏ ਹਾਂ ਸਰ ਮੈਂ ਵੀ ਕੱਲ੍ਹ ਗਿਆ ਸੀ ਅੰਬਰਸਰ ਉੱਥੇ ਤਾਂ ਪਰ ਬਹੁਤ ਸਾਰੇ ਆ ਬਹੁਤ ਤਰੱਕੀ ਹੋਈ ਆ ਲਾਈਟਾਂ ਵਗੈਰਾ ਲੱਗੀਆਂ ਵਾਂ ਪੁਲ ਮਤਲਬ ਹੈਗੇ ਆ ਪਰ ਆਪਣੇ ਇੱਥੇ ਕੁਝ ਨਹੀਂ ਹੈਗਾ ਇਹਨਾਂ ਦੇ ਤਾਂ ਇਹਨਾਂ ਦੇ ਤਾਂ ਆਪਣੇ ਢਿੱਡ ਭਰ ਜਾਣ ਇੰਨਾ ਹੀ ਬੜਾ ਵਾ ਜੀ ਇਹਨਾਂ ਲਾਉਣਾ ਕੀ ਆ ਕੀ ਬਣਾਉਣੀਆਂ ਸੜਕਾਂ ਇਹਨਾਂ ਆਪਣਾ ਆਪਣੀਆਂ ਜੇਬਾਂ 'ਚ ਹੀ ਪੈ ਜਾਂਦੇ ਇੰਨਾ ਨਹੀਂ ਬੜਾ ਇਹ ਸਰਕਾਰਾਂ ਰਲੀਆਂ ਆਪਸ ਜੀ ਹੁਣ ਇੰਨਾ ਸਰਕਾਰਾਂ ਉੱਤੋਂ ਪੈਸੇ ਆਉਂਦੇ ਆ ਇਹ ਬਣਾਉਣ ਹਾਂ ਗਰੀਬਾਂ ਨੂੰ ਐਵੇਂ ਦੁੱਖ ਤਕਲੀਫ ਦਿੰਦੇ ਆ ਇਹਦੇ ਨਾਲ ਤੋਂ ਮਤਲਬ ਬਾਹਰਲੇ ਦੇਸ਼ ਹੀ ਦੇਸ਼ ਹੀ ਚੰਗੇ ਆ ਜੋ ਵੀ ਪੈਸੇ ਮਤਲਬ ਪ੍ਰੋਪਰ ਲੱਗਦੇ ਆ ਇੱਥੇ ਅ ਇਹ ਤਾਂ ਇਹੋ ਗੱਲ ਆ ਜੀ ਜੇ ਨੌਕਰੀਆਂ ਮਿਲਦੀਆਂ ਨਹੀਂ ਆ ਹੈਂ ਇੱਥੇ ਤਾਂ ਸੜਕਾਂ ਟੁੱਟੀਆਂ ਵਾ ਐਕਸੀਡੈਂਟ ਹੋਈ ਜਾਂਦੇ ਆ ਲੋਕ ਮਰੀ ਜਾਂਦੇ ਆ ਸਰਕਾਰ ਨੂੰ ਕੋਈ ਇਹਦਾ ਕੋਈ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ ਬਸ ਆਪਣਾ ਢਿੱਡ ਭਰਨਾ ਚਾਹੀਦਾ ਵਾ ਇਹਨਾਂ ਦੇ ਆਪਣੇ ਘਰ ਭਰਨੇ ਚਾਹੀਦੇ ਆ ਜੀ ਚਲੋ ਠੀਕ ਹੈ ਫਿਰ ਓਕੇ ਸਰ ਓਕੇ ਜੀ